ਭਾਸ਼ਾ ਅਤੇ ਸੱਭਿਆਚਾਰ ਦਾ ਅਟੁੱਟ ਸੰਬੰਧ ਹੁੰਦਾ ਹੈ ਕਿਸੇ ਦੂਜੇ ਸੱਭਿਆਚਾਰ ਅਤੇ ਭਾਸ਼ਾ ਦਾ ਗਿਆਨ ਕਿੱਤਿਆਂ ਬਾਰੇ ਜ਼ਿਆਦਾ ਪ੍ਰਭਾਵਿਤ ਢੰਗ ਨਾਲ ਗੱਲਬਾਤ ਕਰਨ ਅਤੇ ਦੁਨੀਆਂ ਭਰ ਦੇ ਵਿਅਕਤੀਆਂ ਨਾਲ ਗੱਲਬਾਤ ਨੂੰ ਹੋਰ ਸੌਖਾ ਬਣਾ ਕੇ ਮਜ਼ਬੂਤ ਵਪਾਰਕ ਸੰਬੰਧ ਬਣਾਉਣ ਵਿੱਚ ਮਦਦ ਕਰਦਾ ਹੈ ਸਾਡੀ ਪੰਜਾਬੀ ਭਾਸ਼ਾ ਦੀ ਵਰਤੋਂ ਸਥਾਨਕ ਆਰਥਿਕਤਾ 'ਤੇ ਕਾਫ਼ੀ ਪ੍ਰਭਾਵ ਪਾਉਂਦੀ ਹੈ ਵਪਾਰਿਕ ਖੇਤਰ ਵਿੱਚ ਪੰਜਾਬੀ ਭਾਸ਼ਾ ਰਾਹੀਂ ਦੂਜਿਆਂ ਨਾਲ ਆਪਣੇ ਵਿਚਾਰ ਸੁਭਾਵਿਕ ਰੂਪ ਨਾਲ ਅਸੀਂ ਸਾਂਝੇ ਕਰ ਲੈਂਦੇ ਹਾਂ ਕਿਉਂਕਿ ਇਸ ਭਾਸ਼ਾ 'ਚ ਅਸੀਂ ਪੂਰੀ ਤਰ੍ਹਾਂ ਨਿਪੁੰਨ ਹੁੰਦੇ ਹਾਂ ਅਤੇ ਆਪਣੇ ਮਨ ਦੇ ਭਾਵ ਵਪਾਰ ਦੀਆਂ ਬਰੀਕੀਆਂ ਬੜੀ ਆਸਾਨੀ ਨਾਲ ਸਮਝ ਸਕਦੇ ਹਾਂ ਅਤੇ ਦੂਜਿਆਂ ਨੂੰ ਸਮਝਾ ਸਕਦੇ ਹਾਂ ਕਿਉਂਕਿ ਵੱਖ ਵੱਖ ਵਪਾਰੀ ਜਿਨ੍ਹਾਂ ਨਾਲ ਭਾਸ਼ਾ ਸੱਭਿਆਚਾਰਕ ਸਾਂਝ ਹੋਣ ਕਾਰਣ ਅਸੀਂ ਆਪਣੀ ਗੱਲਬਾਤ ਵਿੱਚ ਸੋਖ ਅਨੁਭਵ ਕਰਦੇ ਹਾਂ ਸਾਡੀ ਭਾਸ਼ਾ ਸਾਨੂੰ ਅੰਤਰਿਕ ਵਿਚਾਰਾਂ ਭਾਵਨਾਵਾਂ ਨੂੰ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਅੱਜ ਭਾਵੇ ਦੁਨੀਆਂ ਵਿੱਚ ਸੱਤ ਹਜ਼ਾਰ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਜਿਹੜੀ ਸਾਡੀ ਆਪਣੀ ਭਾਸ਼ਾ ਹੁੰਦੀ ਹੈ ਜਿਵੇਂ ਕਿ ਸਾਡੀ ਆਪਣੀ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਅੱਜ ਦੇ ਦੌਰ ਵਿੱਚ ਵਪਾਰ ਸੰਚਾਲਨ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ